ਕਲਾ ਅਤੇ ਸ਼ਿਲਪਕਾਰੀ ਖੇਤਰ ਨੂੰ ਕਿਸੇ ਸੰਸਕ੍ਰਿਤਿਕ ਦੇ ਰਾਜ ਦਾ ਸੱਭਿਆਚਾਰਕ ਮਾਨਾ ਜਾਂਦਾ ਹੈ ਇਸ ਲਈ ਉਸਦਾ ਯੋਗਦਾਨ ਪਰਾਵਾਂ ਚਿੰਨ੍ਹ ਅਤੇ ਮੂਲ ਰਾਜ ਦੇ ਸੰਪਰਦਾਇਕ ਸੰਸਕ੍ਰਿਤੀ ਦੇ ਭੂਗੋਲਿਕ ਅਤੇ ਸਮਾਜਿਕ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਇਸ ਖੇਤਰ ਵਿੱਚ ਰਾਜ ਦੀ ਪਛਾਣ ਵਿੱਚ ਪਰੰਪਰਾਵਾਂ ਦੀ ਮਹੱਤਤਾ ਕਿਉਂਕਿ ਇਹ ਕਲਾ ਅਤੇ ਸ਼ਿਲਪਕਾਰੀ ਕਲਾ ਸੰਸਕ੍ਰਿਤੀ ਨੂੰ ਮਜ਼ਬੂਤੀ ਦੇਣ ਵਾਲੇ ਰਾਜ ਵਿੱਚ ਪਰੰਪਰਾਵਾਂ ਸਮੇਤ ਸੰਸਕ੍ਰਿਤੀ ਦੀ ਵਿਵਸਥਾ ਅਤੇ ਗੌਰਵ ਨੂੰ ਉਤਸ਼ਾਹਿਤ ਕਰਨ ਵਾਲੇ ਚਿੰਨ੍ਹ ਅਤੇ ਸੰਕੇਤ ਅਤੇ ਫੁਲ ਹੁੰਦੇ ਹਨ ਇਹ ਚਿੰਨ੍ਹ ਅਤੇ ਮੂਲ ਕਲਾ ਅਤੇ ਸ਼ਿਲਪਕਾਰੀ ਕਲਾ ਦੀ ਮੂਲ ਭਾਸ਼ਾ ਹਨ ਜੋ ਕਿ ਸੰਸਕ੍ਰਿਤੀ ਅਤੇ ਐਸਚਿਕ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਇਸ ਰਾਜ ਦੀ ਯੋਗਤਾਨਾ ਦੇ ਰੂਪ ਵਿੱਚ ਸ਼ਿਲਪਕਾਰੀ ਖੇਤਰ ਨੂੰ ਵਧੇਰੇ ਮੁੱਕਦਮਿਆਂ ਮੈਜ਼ੀਕਲ ਪ੍ਰੋਜੈਕਟਾਂ ਜਿਵੇਂ ਕਿ ਮਹੱਤਵਪੂਰਨ ਇਮਾਰਤਾਂ ਮੂਲ ਸਾਜੀ ਅਤੇ ਰੰਗ ਵੀਕਾਰਨ ਜਿਵੇਂ ਕਿ ਪੇਂਟਿੰਗ ਅਤੇ ਸਕਲਚਰ ਵਿੱਚ ਆਪਣੇ ਇਨਸਾਨਾਂ ਦੀ ਵਿਕਾਸ ਦੀ ਯੋਗਦਾਨ ਪਾਇਆ ਜਾਂਦਾ ਇਹ ਯੋਗਦਾਨ ਕਲਾ ਅਤੇ ਸ਼ਿਲਪਕਾਰੀ ਕਲਾ ਦੀ ਬਿਰਤਾਰਾ ਵਿੱਚ ਉਹਨਾਂ ਦੇ ਅਹਿਮ ਪੈਰਾਮੀਟਰਾਂ ਵਿੱਚ ਸੁਧਾਰ ਕਰਨ ਵਿੱਚ ਸਹਾਇਕ ਹੁੰਦੇ ਹਨ ਰਾਜ ਚੋਗ ਦੀ ਯੋਗਤਾਨਾ ਦੇ ਤੌਰ 'ਤੇ ਪਰੰਪਰਾਵਾਂ ਅਤੇ ਸ਼ਿਲਪਕਾਰੀ ਸੰਸਕ੍ਰਿਤੀ ਬਹੁਤ ਹੀ ਮਜ਼ਬੂਤ ਹੋਣੀ ਚਾਹੀਦੀ